ਪਾਲਕ ਪਨੀਰ ਮਟਰ ਪਨੀਰ ਖੁੰਬਾਂ ਸਾਗ ਆਲੂ ਗੋਭੀ ਗਾਜਰ ਮਟਰ ਮੱਕੀ ਦੀ ਰੋਟੀ ਕਣਕ ਦੀ ਰੋਟੀ ਬਾਜਰੇ ਦੀ ਰੋਟੀ ਚਾਵਲ ਦੀ ਰੋਟੀ ਕੋਦਰੇ ਦੀ ਰੋਟੀ ਸ਼ਲਗਮ ਪਾਲਕ ਦੜ੍ਹਾਉ ਦੀ ਰੋਟੀ ਸੁਆਂਗ ਦੇ ਚਾਵਲ ਕਰੇਲੇ ਚੱਪਣ ਕੱਦੂ ਫਲੀਆਂ ਮੂੰਗਰੇ ਭਿੰਡੀ ਬੰਦ ਗੋਭੀ ਘੀਆ ਕੱਦੂ ਗੇਹੂੰ ਚੋਲ ਮੱਕੀ ਬਾਜਰਾ ਜੌ ਦਾਲ ਮਸੁਰ ਦੀ ਦਾਲ ਮੂੰਗ ਦੀ ਦਾਲ ਚਨੇ ਦੀ ਦਾਲ ਅਰਹਰ ਦੀ ਦਾਲ ਆਲੂ ਪਿਆਜ਼ ਟਮਾਟਰ ਗਾਜਰ ਫੁੱਲ ਗੋਭੀ ਬੰਦ ਗੋਭੀ ਮੁਲੀ ਸ਼ਿਮਲਾ ਮਿਰਚ ਟਿੰਡਾ ਕਰੇਲਾ ਕੱਦੂ ਬੈਂਗਣ ਲੋਕੀ ਮੇਥੀ ਪਾਲਕ ਕੇਲਾ ਸੰਤਰਾ ਸੇਬ ਅਨਾਰ ਅੰਗੂਰ ਅਨਾਨਾਸ ਨਾਸਪਾਤੀ ਤਰਬੂਜ਼ ਖਰਬੂਜਾ ਲੀਚੀ ਆਲੂ ਬਖਾਰਾ ਪਪੀਤਾ ਆੜੂ ਜਾਮੁਨ ਅੰਬ ਦੁੱਧ ਦਹੀਂ ਮੱਖਣ ਪਨੀਰ ਸ਼ਾਸ਼ ਖੋਆ ਲੂਣ ਹਲਦੀ ਮਿਰਚ ਧਨੀਆ ਜੀਰਾ ਗਰਮ ਮਸਾਲਾ ਲੌਂਗ ਦਾਲ ਚੀਨੀ ਹਿੰਗ ਜਲੇਬੀ ਗੁਲਾਬ ਜਾਮੁਨ ਲੱਡੂ ਰਾਸਗੁੱਲਾ ਪੇੜਾ ਖੀਰ ਪਰਾਂਠਾ ਰੋਟੀ ਦਲੀਆ ਪਕੌੜੇ ਸਮੋਸੇ ਮਟਰੀ ਨਾਨ ਛੋਲੇ ਭਟੂਰੇ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਆਦਿ ਧੰਨਵਾਦ